ਸੂਟ ਦਾ ਨਾਪ ਲੈਣ ਲਈ ਸਾਡੇ ਕੋਲ ਇੰਚੀ ਟੇਪ ਅਤੇ ਕਾਗਜ਼ ਹੋਣਾ ਬਹੁਤ ਜ਼ਰੂਰੀ ਹੈ ਸੂਟ ਦਾ ਨਾਪ ਲੈਣ ਲਈ ਸਭ ਤੋਂ ਪਹਿਲਾਂ ਲੰਬਾਈ ਕਿੰਨੇ ਇੰਚ ਹੋਣੀ ਚਾਹੀਦੀ ਹੈ ਉਹ ਦੇਖਾਂਗੇ ਘੇਰਾ ਘੇਰਾ ਕਿੰਨੇ ਇੰਚ ਰੱਖਣਾ ਹੈ ਉਹ ਦੇਖਾਂਗੇ ਫਿਰ ਤੀਰਾ ਅਸੀਂ ਕਿੰਨੇ ਇੰਚ ਰੱਖਣਾ ਹੈ ਉਹ ਦੇਖਾਂਗੇ ਇੰਚੀ ਟੇਪ ਨਾਲ ਛਾਤੀ ਮਿਣਾਂਗੇ ਆਲੇ ਦੁਆਲੇ ਕਮਰ ਆਲਾ ਦੁਆਲਾ ਮਿਣ ਕੇ ਅਸੀਂ ਕਿੰਨੇ ਇੰਚ ਰੱਖਣੀ ਹੈ ਉਹ ਦੇਖਾਂਗੇ ਤਰੀਜ ਕਿੰਨੇ ਇੰਚ ਲੰਬੀ ਹੋਣੀ ਚਾਹੀਦੀ ਹੈ ਉਹ ਦੇਖਾਂਗੇ ਫਿਰ ਅਸੀਂ ਬਾਜੂ ਦੀ ਲੰਬਾਈ ਮਿਨਾਂਗੇ ਇਸ ਤੋਂ ਬਾਅਦ ਅਸੀਂ ਮੋਰੀ ਮਿਨਾਂਗੇ ਕਿੰਨੇ ਇੰਚ ਰੱਖਣੀ ਹੈ ਫਿਰ ਅਸੀਂ ਪੈਂਟ ਦੀ ਲੰਬਾਈ ਮਿਨਾਂਗੇ ਕਿੰਨੇ ਇੰਚ ਹੋਣੀ ਚਾਹੀਦੀ ਹੈ ਪੈਂਟ ਦੀ ਲੰਬਾਈ ਮਿਨਣ ਤੋਂ ਬਾਅਦ ਅਸੀਂ ਪੋਂਚਾ ਦੇਖਾਂਗੇ ਕਿੰਨੇ ਇੰਚ ਰੱਖਣਾ ਹੈ